ਸਾਡੇ ਪਿੰਡ ਵਿੱਚ ਦੀਆਂ ਸਹੂਲਤਾਂ ਹਨ ਸਾਡੀ ਜ਼ਮੀਨ ਦੇ ਹਾਲਾਤ ਬਹੁਤ ਚੰਗੇ ਹਨ ਇਸ ਜ਼ਮੀਨ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਫਸਲਾਂ ਬੀਜਦੇ ਹਾਂ ਜਿਵੇਂ ਕਿ ਕਣਕ ਝੋਨਾ ਸਰ੍ਹੋਂ ਤੋਰੀਆਂ ਨਰਮਾ ਕਪਾਹ ਫਲ ਅਤੇ ਸਬਜ਼ੀਆਂ ਇਸ ਦੇ ਨਾਲ ਨਾਲ ਪਸ਼ੂਆਂ ਦਾ ਚਾਰਾ ਬੀਜਦੇ ਹਾਂ